ਹੈਲੋ ਹਾਂਜੀ ਹਾਂਜੀ ਮੈਮ ਤੁਸੀਂ ਸੋਚ ਸਕਦੇ ਹੋ ਤੋ ਗੱਲ ਕਰ ਰਹੇ ਹੋ ਜੋ ਪੀਆਰ ਵਗੈਰਾ ਸੋ ਹਾਂਜੀ ਮੈਮ ਮੈਂ ਨਾ ਸੋਪ ਦੇ ਲੈਣੇ ਸੀ ਵਡੇ ਵਾਧੂ ਸਾਰੇ ਹਾਂਜੀ ਤੇ ਤੇ ਮੈਮ ਫਾਜ਼ਿਲਕਾ ਐਡਰੈਸ ਹਾਊਸ ਨੰਬਰ ਅੱਠ ਸੋ ਛੱਤੀ ਧੋਬੀ ਘਾਟ ਸੀਟ ਨੰਬਰ ਵਨ ਫਾਜ਼ਿਲਕਾ ਤੇ ਡਿਲੀਵਰ ਤੁਸੀਂ ਪਹੁੰਚਾਣੇ ਹੈ ਤੇ ਐਹਨਦੇ ਬਾਰੇ ਮੈਂ ਸੋਪ ਬਾਰੇ ਪੁੱਛਣਾ ਸੀ ਸਾਬਣਾ ਬਾਰੇ ਤੇ ਮੈਮ ਤੁਹਾਡੇ ਤੋਂ ਪਹਿਲੇ ਪਹਿਲੇ ਸਾਬਣ ਦੀ ਹਬੀ ਹ ਹਾਂਜੀ ਹਾਂਜੀ ਹਾਂਜੀ ਮੈਮ ਜੋ ਦਾ ਤੇ ਪੀਅਰਸ ਦਾ ਰੇਟ ਦੱਸ ਦੋ ਹਾਂਜੀ ਮੈਮ ਉਹਦੇ ਚ ਕਿੰਨੇ ਪੀਸ ਹੋਣਗੇ ਹਾਂਜੀ ਹਾਂਜੀ ਮੈਮ ਤੇ ਭਾਵਾਂ ਆਪਾਂ ਜਿਵੇਂ ਹਜਾਰ ਟੂ ਪੀਸ ਲੈਣਾ ਹੋਵੇ ਤੇ ਉਹਦੇ ਤੇ ਆਪਾਂ ਨੂੰ ਕੀ ਛੂਟ ਮਿਲੇ ਵੀ ਤੇ ਕੀ ਰੇਟ ਹੈ ਹਾਂਜੀ ਤੇ ਰੇਟ ਨਹੀਂ ਨਹੀਂ ਜਿਵੇਂ ਇੱਕ ਡੱਬੇ ਵਿੱਚ ਆਪਾਂ ਨੂੰ ਚਾਲੀ ਪੀਸ ਨਿਕਲ ਰਹੇ ਹ ਤੇ ਪਰ ਪੀਸ ਆਪਾਂ ਨੂੰ ਕਿੰਨਾ ਰੇਟ ਪਏਗਾ ਹਾਂਜੀ ਹਾਂਜੀ ਤੇ ਮੈਮ ਕਿੰਨੇ ਦਿਨਾਂ ਵਿੱਚ ਤੁਸੀਂ ਪਹੁੰਚਾ ਸਕਦੇ ਹੋ ਮੈ ਮੈਮ ਆਨਲਾਈਨ ਪੇਮੈਂਟ ਤੇ ਆਨਲਾਈਨ ਹੀ ਚਾਹੀਦੀ ਡਿਲੀਵਰੀ ਵੀ ਤੇ ਮੈਮ ਮੈਨੇ ਇਹ ਚ ਸੋਪ ਕੋਈ ਆਪਾਂ ਨੂੰ ਖਰਾਬ ਤਾਂ ਨਹੀਂ ਕਰਨਗੇ ਜਿਵੇਂ ਹੁਣ ਸਾਡੇ ਘਰ ਚ ਬੱਚੇ ਹੈਗੇ ਆ ਉਹ ਯੂਜ ਕਰੋਗੇ ਉਹ ਇਸਤੇਮਾਲ ਕਰਨ ਤੇ ਉਹਨਾਂ ਤੇ ਕੋਈ ਅੱਖਾਂ ਤੇ ਜਾਂ ਕੋਈ ਹੋਰ ਚਿਹਰੇ ਤੇ ਕੋਈ ਫਰਕ ਤਾਂ ਨਹੀਂ ਪਏਗਾ ਤੇ ਕੈਮੀਕਲ ਕੋਈ ਜਿਆਦਾ ਤਾਂ ਨਹੀਂ ਪਾਏ ਹੋਣਗੇ ਹਾਂਜੀ ਤੇ ਮੈਮ ਸਾਡੇ ਕੋਲ ਬੱਚਿਆਂ ਲਈ ਜੋਨਸਨ ਬੇਬੀ ਸੋਪ ਮਿਲ ਜੇਗਾ ਹਾਂਜੀ ਹੋਰ ਕੋਈ ਸੋਪ ਨਵੇਂ ਆਏ ਹੋਣ ਹਾਂਜੀ ਹਾਂਜੀ ਕੋਈ ਕੰਪਲੇਂਟ ਵਗੈਰਾ ਤਾਂ ਨਹੀਂ ਆਏਗੀ ਠੀਕ ਹੈ ਜੀ ਧੰਨਵਾਦ